ਮੈਂ ਆਪਣੀ ਸਕੂਲੀ ਵਿੱਦਿਆ ਸਕੂਲ ਰੂਲਰ ਇੰਸਟੀਟਿਉਟ ਫੋਰ ਕਰੀਅਰ ਕੋਰਸਿਸ ਪਸੀ ਬੁੱਧਰਾ ਤੋਂ ਹਾਸਿਲ ਕੀਤੀ ਮੇਰੀ ਸਕੂਲੀ ਵਿੱਦਿਆ ਬਹੁਤ ਹੀ ਵਧੀਆ ਸਕੂਲ ਵਿੱਚ ਹੋਈ ਸਕੂ ਮੇਰਾ ਸਕੂਲ ਬਹੁਤ ਹੀ ਵਧੀਆ ਸੀ ਅਤੇ ਬਹੁਤ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖਿਆ ਪ੍ਰਦਾਨ ਕਰਦਾ ਸੀ ਦਸਵੀਂ ਤੋਂ ਬਾਅਦ ਮੈਂ ਕਮਰਸ ਸਟਰੀਮ ਸੁਣੀ ਕਿਉਂਕਿ ਮੇਰਾ ਦਿਲਚਸਪ ਹਿਸਾਬ ਕਿਤਾਬ ਅਤੇ ਵਪਾਰ ਵਿੱਚ ਜ਼ਿਆਦਾ ਰਹਿੰਦਾ ਸੀ ਇਸ ਲਈ ਮੈਂ ਦਸਵੀਂ ਤੋਂ ਬਾਅਦ ਗਿਆਰਵੀਂ ਬਾਰ੍ਹਵੀਂ ਕਮਰਸ ਵਿੱਚ ਪੜ੍ਹੀ ਅਤੇ ਮੈਂ ਹਾਲ ਹੀ ਵਿੱਚ ਮੈਂ ਆਪਣੀ ਹਾਲ ਹੀ ਵਿੱਚ ਮੈਂ ਆਪਣੀ ਬਾਰ੍ਹਵੀਂ ਪੂਰੀ ਕੀਤੀ ਅਤੇ ਅੱ ਅੱਸੀ ਪ੍ਰਸੈਂਟ ਨੰਬਰ ਹਾਸਲ ਕੀਤੇ